ਮੈਂ ਆਪਣੇ ਕਿਰਦਾਰ ਨੂੰ ਹਮੇਸ਼ਾਂ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਵੀ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸ਼ਬਦ ਨਹੀਂ ਲਿਖਿਆ ਜਾਂ ਅਪਸ਼ਬਦ ਨਹੀਂ ਲਿਖਿਆ ਜਿਸ ਨਾਲ ਕਿਸੇ ਵੀ ਮਨੁੱਖ ਨੂੰ ਠੇਸ ਪਹੁੰਚੇ ਜਾਂ ਮੈਂ ਕਿਸੇ ਕਿਸਮ ਦੀ ਕੋਈ ਵੀ ਅਪਸ਼ਬਦ ਬੋਲ ਕੇ ਜਾਂ ਲਿਖ ਕੇ ਮਸ਼ਹੂਰੀ ਨਹੀਂ ਲੈਣਾ ਚਾਹੁੰਦਾ ਮੈਂ ਜਿੰਨਾ ਵੀ ਲਿਖਦਾ ਹਾਂ ਉਹਦੇ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਹੀ ਲਿਖਦਾ ਹਾਂ